ਰੋਪੜ ਵਿੱਚ ਇੱਕ ਪ੍ਰਸਿੱਧ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜਿਸ ਦਾ ਨਾਮ ਹੈ ਗੁਰਦੁਆਰਾ ਟਿੱਬੀ ਸਾਹਿਬ ਜੋ ਕਿ ਸਤਲੁਜ ਦੇ ਕੰਢੇ ਉੱਤੇ ਰੋਪੜ ਤੋਂ ਜਲੰਧਰ ਜਾਣ ਵਾਲੀ ਸੜਕ ਦੇ ਕਿਨਾਰੇ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਪੁਰਾਣੀ ਕਾਰ ਖੜ੍ਹੀ ਹੈ ਜੋ ਉੱਨੀ ਸੌ ਚਾਲੀ ਦਾ ਮਾਡਲ ਹੈ ਇਹ ਕਾਰ ਸੰਤ ਹਰਖੋਵਾਲ ਜੀ ਨੂੰ ਕਿਸੇ ਸੇਵਕ ਦੁਆਰਾ ਭੇਟ ਕੀਤੀ ਗਈ ਸੀ ਇਹਦੇ ਨਾਲ ਜੁੜੀ ਹੋਈ ਕਹਾਣੀ ਇਹ ਹੈ ਕਿ ਉਨ੍ਹਾਂ ਟਾਈਮਾਂ ਦੇ ਵਿੱਚ ਉਹਨਾਂ ਵੇਲਿਆਂ ਵਿੱਚ ਜਦੋਂ ਸੰਤ ਹਰਖੋਵਾਲ ਜੀ ਕਿਤੋਂ ਬਾਹਰੋਂ ਆ ਆ ਰਹੇ ਸਨ ਤਾਂ ਸਤਲੁਜ ਦਰਿਆ ਵਿੱਚ ਕਾਫ਼ੀ ਹੜ੍ਹ ਆਇਆ ਹੋਇਆ ਸੀ ਪਾਣੀ ਕਾਫ਼ੀ ਚੜਿਆ ਹੋਇਆ ਸੀ ਅਤੇ ਉਸ ਕਾਰ ਦੇ ਡਰਾਈਵਰ ਨੇ ਇਹ ਕਿਹਾ ਕਿ ਬਾਬਾ ਜੀ ਪਾਣੀ ਬਹੁਤ ਜ਼ਿਆਦਾ ਹੈ ਅਤੇ ਆਪਾਂ ਪਾਰ ਨਹੀਂ ਲੰਘ ਸਕਾਂਗੇ ਅਤੇ ਆਪਾਂ ਨੂੰ ਇੱਧਰ ਹੀ ਰਹਿਣਾ ਪੈਣਾ ਹੈ ਪਰ ਸੰਤ ਜੀ ਨੇ ਜਾਣਾ ਸੀ ਦੂਜੇ ਪਾਸੇ ਤਾਂ ਉਹਨਾਂ ਨੇ ਡਰਾਈਵਰ ਨੂੰ ਕਿਹਾ ਕਿ ਨਹੀਂ ਤੁਸੀਂ ਗੱਡੀ ਚਲਾਓ ਅਤੇ ਆਪਾਂ ਪਰਲੇ ਪਾਰ ਜਾਣਾ ਹੈ ਅਤੇ ਗੱਡੀ ਨੂੰ ਪਾਣੀ ਵਿੱਚ ਬਾੜਣ ਦਾਖ਼ਲ ਕਰਨ ਲਈ ਕਿਹਾ ਜਿਵੇਂ ਹੀ ਗੱਡੀ ਪਾਣੀ ਦੇ ਅੰਦਰ ਡਰਾਈਵਰ ਨੇ ਚਲਾਉਣੀ ਸ਼ੁਰੂ ਕੀਤੀ ਤਾਂ ਪਤਾ ਹੀ ਨਹੀਂ ਲੱਗਿਆ ਕਿ ਉਹ ਕਿਹੜੇ ਵੇਲੇ ਦੂਜੇ ਪਾਸੇ ਪਾਰ ਹੋ ਗਈ ਇਹ ਕਹਾਣੀ ਕਾਫ਼ੀ ਪ੍ਰਚਲਿਤ ਹੈ ਅਤੇ ਇਸ ਦਾ ਇਤਿਹਾਸ ਵੀ ਗੁਰਦੁਆਰਾ ਸਾਹਿਬ ਵਿੱਚ ਉਸ ਕਾਰ ਦੇ ਨਾਲ ਜਿੱਥੇ ਕਿ ਇਸਨੂੰ ਖੜਾਇਆ ਗਿਆ ਹੈ ਲਿਖਿਆ ਹੋਇਆ ਹੈ